ਸਾਡੇ ਖੇਤੀਬਾੜੀ ਵਾਲੇ ਵਰਤੇ ਜਾਣ ਵਾਲੇ ਸਾਧਨ ਮੁੱਖ ਤੌਰ 'ਤੇ ਟਰੈਕਟਰ ਅਤੇ ਉਹਨਾਂ ਦੇ ਨਾਲ ਹਲਾਂ ਸੁਹਾਗਾ ਡਰਿੱਲ ਅਤੇ ਰੋਟਾਵੇਟਰ ਟਰਾਲੀ ਇਹ ਕਾਫੀ ਸੰਦ ਜਿਹੜੇ ਇਹ ਖੇਤੀਬਾੜੀ ਵਿੱਚ ਕੰਮ ਆਉਂਦੇ ਆ

ਇਹਨਾਂ ਤੋਂ ਬਗੈਰ ਅਸੀਂ ਖੇਤੀਬਾੜੀ ਨਹੀਂ ਕਰ ਸਕਦੇ ਇਹਨਾਂ ਦੀ ਸਾਂਭ ਸੰਭਾਲ ਵੀ ਸਾਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਅਸੀਂ ਇਹਨਾਂ ਦੀ ਸਾਂਭ ਸੰਭਾਲ ਨਹੀਂ ਕਰਦੇ ਜੰਗਾਲ ਲੱਗ ਜਾਵੇਗਾ ਜੇ ਅਸੀਂ ਉਹਨੂੰ ਗਰੀਸ ਨਹੀਂ ਕਰਦੇ ਤਾਂ ਉਹ ਜਾਮ ਹੋ ਜਾਵੇਗਾ ਇਸ ਕਰਕੇ ਸਾਨੂੰ ਇਹਨਾਂ ਦਾ ਵੀ ਧਿਆਨ ਬਹੁਤ ਰੱਖਣਾ ਪੈਂਦਾ ਹੈ ਅਸੀਂ ਜਦੋਂ ਵੀ ਸੀਜਨ ਖਤਮ ਹੁੰਦਾ ਹੈ ਟਰੈਕਟਰ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰਕੇ ਅਤੇ ਉਹਨੂੰ ਬਰਾਂਡੇ ਦੇ ਵਿੱਚ ਖੜ੍ਹਾ ਕਰ ਦਿੰਦੇ ਹਾਂ ਅਤੇ ਜਿਹੜੀਆਂ ਹਲਾਂ ਉਹਨਾਂ ਨੂੰ ਵੀ ਅਸੀਂ ਜ਼ਮੀਨ ਤੋਂ ਉੱਪਰ ਰੱਖਦੇ ਹਾਂ ਥੱਲੇ ਉਹਨਾਂ ਦੇ ਇੱਟਾਂ ਦੇ ਕੇ ਉੱਪਰ ਰੱਖਦੇ ਕਿਉਂਕਿ ਉਹਨਾਂ ਨੂੰ ਜੰਗਾਲ ਨਾ ਲੱਗੇ ਖਰਾਬ ਨਾ ਹੋਣ ਅਤੇ ਉਹਨਾਂ ਨੂੰ ਸਮੇਂ ਸਮੇਂ 'ਤੇ ਅਸੀਂ ਗਰੀਸ ਕਰਦੇ ਰਹਿੰਦੇ ਹਾਂ ਬਾਕੀ ਵੀ ਜਿਹੜੇ ਸੰਦ ਨੇ ਉਹਨਾਂ ਨੂੰ ਵੀ ਅਸੀਂ ਧੋ ਕੇ ਜਦੋਂ ਸੀਜਨ ਖਤਮ ਹੋ ਜਾਂਦਾ ਹੈ ਤਾਂ ਆਪਣੇ ਬਰਾਂਡੇ ਦੇ ਵਿੱਚ ਰੱਖਦੇ ਹਾਂ ਜਿੱਥੇ ਕਿ ਉਹਨਾਂ ਨੂੰ ਜੰਗਾਲ ਨਾ ਲੱਗੇ ਤਰੇਲ ਨਾ ਪਵੇ ਜਾਂ ਮੀਂਹ ਦੇ ਵਿੱਚ ਉਹ ਖਰਾਬ ਨਾ ਹੋਣ